ਸਰਕਾਰ ਦੀਆਂ ਵੱਖ ਵੱਖ ਕਿਸਮਾਂ ਜਿਵੇਂ ਕਿ ਆਯੂਸ਼ਮਾਨ ਭਾਰਤ ਯੋਜਨਾ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਅਤੇ ਆਮ ਆਦਮੀ ਬੀਮਾ ਯੋਜਨਾ ਅਤੇ ਸੈਂਟਰਲ ਗੌਰਮੈਂਟ ਹੈਲਥ ਸਕੀਮ ਇਹ ਬਹੁਤ ਵੱਖ ਵੱਖ ਤਰ੍ਹਾਂ ਦੀਆ ਸਕੀਮਾਂ ਹਨ ਜੋ ਕਿ ਸਾਡੇ ਦੇਸ਼ ਦੇ ਵਿੱਚ ਸਰਕਾਰ ਦੁਆਰਾ ਲਾਗੂ ਕੀਤੇ ਗਏ ਹਨ ਅਤੇ ਹਜੇ ਤੱਕ ਮੈਂ ਇਹਨਾਂ ਦੇ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਦਾ ਇਸਤੇਮਾਲ ਕੀਤਾ ਹੈ ਇਸ ਨੂੰ ਭਰਨ ਦਾ ਸਿੰਪਲ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ ਆਯੂਸ਼ਮਾਨ ਭਾਰਤ ਯੋਜਨਾ ਦੇ ਸਾਈਟ 'ਤੇ ਵਿਜ਼ਿਟ ਕਰੋ ਅਤੇ ਉੱਥੇ ਫੋਮ ਹੈ ਉਹਨੂੰ ਫਿੱਲ ਕਰ ਦੋ ਅਤੇ ਤੁਹਾਡੇ ਤੁਸੀਂ ਕਿਸ ਲਈ ਕਰਨਾ ਚਾਹੁੰਦੇ ਹਾਂ ਉਹ ਆਪਣਾ ਸਭ ਪੂਰਾ ਜੋ ਹੈ ਲਿਖ ਕੇ ਭਰਦੋ ਬਸ